ਹੈਲੋ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਜੀ ਜੀ ਜੀ ਵੈੱਲਕਮ ਵੈੱਲਕਮ ਸਰ ਵੈੱਲਕਮ ਵੈੱਲਕਮ ਜੀ ਜੀ ਜੀ ਸਰ ਮੌਸਮ ਤਾਂ ਠੀਕ ਹੈ ਨਾ ਕੋਈ ਗਰਮੀ ਨਾ ਸਰਦੀ ਕਿ ਬਹੁਤ ਵਧੀਆ ਬੜਾ ਸੁਹਾਵਣਾ ਮੌਸਮ ਹੈ ਨਹੀਂ ਨਹੀਂ ਨਹੀਂ ਨਹੀਂ ਜੇ ਤਾਂ ਤੁਸੀਂ ਰੁਕਣਾ ਹੈਗਾ ਮਤਲਬ ਦਸੰਬਰ ਤੀਕਰ ਹੈ ਨਾ ਸਤੰਬਰ ਸਤੰਬਰ ਮਹੀਨਾ ਹੈ ਨਾ ਜੇ ਤੁਸੀਂ ਦਸੰਬਰ ਜਨਵਰੀ ਵਿੱਚ ਰੁਕਣਾ ਫੇਰ ਤਾਂ ਮੋਟੇ ਕੱਪੜਿਆਂ ਦੀ ਲੋੜ ਹੈਗੀ ਹੈ ਪਰ ਜੇ ਤੁਸੀਂ ਛੇਤੀ ਵਾਪਸ ਚਲੇ ਜਾਣਾ ਫੇਰ ਹਲਕੇ ਜਿਹੇ ਕੱਪੜੇ ਲੈ ਆਓ ਗਰਮ ਜ਼ਿਆਦਾ ਨਹੀਂ ਕਿਉਂਕਿ ਅੱਜਕਲ ਤਾਂ ਗਰਮੀ ਹੈ ਵੈਸੇ ਨਾ ਗਰਮੀ ਨਾ ਸਰਦੀ ਹੈ ਰੇਨ ਕੋਟ ਸਰ ਲੈ ਆਉ ਇੱਥੇ ਨਾ ਬਾਰਿਸ਼ਾਂ ਬੁਰਿਸ਼ਾਂ ਹੋ ਰਹੀਆਂ ਕਾਫ਼ੀ ਪੰਜਾਬ ਵੀ ਸ਼ਾਇਦ ਰੁੜ ਜਾਣਾ ਪਰ ਹੁਣ ਬਚਾਅ ਹੋ ਗਿਆ ਹਾਂ ਰੇਨ ਕੋਟ ਵਗੈਰਾ ਤੁਸੀਂ ਲੈ ਆਉਣਾ ਨਾਲ਼ ਇੱਕ ਦੋ ਦੇ ਨਾਲ਼ ਰੇਨ ਕੋਟ ਅਤੇ ਛੱਤਰੀ ਦੀ ਜ਼ਰੂਰਤ ਪੈਣੀ ਹੈ ਇੱਥੇ ਹਾਂਜੀ ਹਾਂਜੀ ਸਰ ਇਹ ਪਹਾੜੀ ਏਰੀਆ ਮੋਹਾਲੀ ਸਰ ਮੋਹਾਲੀ ਸਰ ਇੱਥੇ ਸਾਡੇ ਗੁਰਦੁਆਰਾ ਸਾਹਿਬ ਨੇ ਅੰਬ ਸਾਹਿਬ ਗੁਰਦੁਆਰਾ ਹੈਗਾ ਸਟੇਡੀਅਮ ਹੈ ਇੱਥੇ ਬਹੁਤ ਵਧੀਆ ਫੇਰ ਬਾਕੀ ਫੇਰ ਮੰਦਰ ਵੀ ਹੈਗੇ ਹੈ ਇੱਥੇ ਮੰਦਰ ਗੁਰਦੁਆਰੇ ਬਹੁਤ ਵਧੀਆ ਸਭ ਕੁਝ ਦੇਖਣ ਲਈ ਅਤੇ ਬਹੁਤ ਵਧੀਆ ਇੱਥੇ ਸਰ ਕ੍ਰਿਕਟ ਦੇ ਮੈਚ ਵੀ ਹੁੰਦੇ ਹੈ ਪਰ ਹੁਣ ਹੈ ਨਹੀਂ ਇੱਥੇ ਮੈਚ ਨਾ ਸਟੇਡੀਅਮ 'ਚ ਮੈਚ ਵਗੈਰਾ ਵੀ ਹੁੰਦੇ ਹੈ ਹਾਂਜੀ ਹਾਂਜੀ ਸਰ ਵੀ ਏ ਵੀ ਆਰ ਸਰ ਮੌਲ ਚਲੇ ਜਾਓ ਬੜਾ ਵਧੀਆ ਸ਼ੋਪਿੰਗ ਮੌਲ ਵੀ ਆਰ ਮੌਲ ਇੱਥੇ ਗਿਆਰਾਂ ਫੇਸ ਦੇ ਵਿੱਚ ਹੈਗਾ ਬੇਸਟੀ ਬੇਸਟਟੈਂਕ ਹੈ ਇਹ ਬੜਾ ਵਧੀਆ ਹੈਗਾ ਸਰ ਇੱਥੇ ਤੁਸੀਂ ਘੁੰਮ ਫਿਰ ਸਕਦੇ ਹੋ ਸਰ ਜੇ ਚੰਡੀਗੜ੍ਹ ਵੱਲ ਨਿਕਲਣਾ ਤਾਂ ਫੇਰ ਜੇ ਚੰਡੀਗੜ੍ਹ ਵੱਲ ਨਿਕਲਣਾ ਤੁਸੀਂ ਅਲਾਂਟਾ ਹੈ ਹਾਂਜੀ ਸਰ ਸ਼ੋਪਇੰਗ ਮੌਲ ਸਰ ਘਰ ਦੇ ਬਰਤਨਾਂ ਤੋ ਲੈ ਕੇ ਹਾਈ ਫਾਈ ਤੁਹਾਡੇ ਕਨੇਡਾ ਤੁਹਾਡੇ ਕੀ ਹੈ ਇੰਗਲੈਡ ਵਾਲੇ ਸਾਰੇ ਬਰੈਂਡ ਇੱਥੇ ਹੈਗੇ ਹੈ ਸਾਡੇ ਕੋਲ਼ ਜਿਹੜਾ ਮਰਜੀ ਸਰ ਬਸ ਇੱਦਾਂ ਕਰਿਓ ਖੁੱਲ੍ਹੇ ਪੈਸੇ ਲੈ ਆਓ ਬਸ ਤੁਸੀਂ ਹੈ ਨਾ ਬਾਕੀ ਤੁਹਾਨੂੰ ਸਾਰਾ ਕੁਛ ਮਿਲੇਗਾ ਸਭ ਕੁਛ ਸਾਰਾ ਕੁਛ ਵਧੀਆ ਵਧੀਆ ਮਿਲੇਗਾ ਤੁਹਾਨੂੰ ਉੱਥੇ ਨਾ ਸਰ ਰੈਸਟੋਂਰੈਟ ਵੀ ਬਹੁਤ ਵਧੀਆ ਵਧੀਆ ਹੈਗੇ ਹੈ ਇੱਥੇ ਅਤੇ ਹਾਂ ਬਹੁਤ ਵਧੀਆ ਰੈਸਟੋਰੈਂਟ ਨੇ ਕੇ ਐੱਫ ਸੀ ਵੀ ਹੈ ਇੱਕ ਰੈਸਟੋਰੈਂਟ ਇੱਥੇ ਆਰ ਕੇ ਵੀ ਹੈਗਾ ਫੇਰ ਇੱਕ ਕਪੂਰ ਹੈ ਸਰ ਹੈ ਨਾ ਅਤੇ ਇੱਕ ਜੁਆਏ ਵੀ ਹੈਗਾ ਰੈਸਟੋਰੈਂਟ ਵੀ ਹੈਗਾ ਹੋਟਲ ਵੀ ਬਹੁਤ ਅੱਛੇ ਹੈਗੇ ਇੱਥੇ ਜੀ ਜੀ ਹਾਂਜੀ ਹਾਂਜੀ ਹਾਂਜੀ ਸਰ ਖਾਣ ਪੀਣ ਲਈ ਪਾਲ ਢਾਬਾ ਹੀ ਹੈ ਸਾਡਾ ਤਾਂ ਲਾਗੇ ਇੱਥੇ ਬਹੁਤ ਵਧੀਆ ਹੈ ਹਾਂ ਇੱਥੇ ਤੁਸੀਂ ਜੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਸਰ ਵੈੱਲਕਮ ਠੀਕ ਹੈ ਸਰ ਵੈੱਲਕਮ ਵੈੱਲਕਮ ਵੈੱਲਕਮ ਓਕੇ